ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਬਾਰੇ ਦੱਸਣ ਜਾ ਰਹੀ ਹਾਂ ਵੈਸੇ ਤਾਂ ਸਾਡੀ ਸਿੱਖਿਆ ਪ੍ਰਣਾਲੀ ਬਹੁਤ ਹੀ ਵਧੀਆ ਹੈ ਪਰ ਹਾਲੇ ਵੀ ਕਈ ਕਈ ਜਗਾਵਾਂ 'ਤੇ ਸਿੱਖਿਆ ਬੜੇ ਹੀ ਜ਼ਿਆਦਾ ਮਾੜੀ ਹੈ ਕਿਉਂਕਿ ਉੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ ਜਾਂਦਾ ਨਾਲ ਬੱਚੇ ਵੀ ਫਿਰ ਨਹੀਂ ਪੜ੍ਹਦੇ ਬਾਕੀ ਸਾਡੇ ਦੇਸ਼ ਦੇ ਸਰਕਾਰੀ ਸਕੂਲਾਂ ਦਾ ਤਾਂ ਬੜਾ ਹੀ ਬੁਰਾ ਹਾਲ ਸੀ ਪਹਿਲੇ ਪਰ ਹੁਣ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਵੱਧਦਾ ਵੱਧਦਾ ਹੀ ਸਕੂਲਾਂ ਵੀ ਸਕੂਲ ਵੀ ਤਰੱਕੀ ਕਰ ਰਹੇ ਹਨ ਸਮਾਰਟ ਸਕੂਲ ਬਣ ਰਹੇ ਹਨ ਪਰ ਜੇ ਵੇਖਿਆ ਜਾਵੇ ਅਗਰ ਸਾਡੇ ਦੇਸ਼ ਦੀ ਤੁਲਨਾ ਬਾਹਰਲੇ ਦੇਸ਼ਾਂ ਨਾਲ ਕੀਤੀ ਜਾਵੇ ਤਾਂ ਹਾਲੇ ਵੀ ਸਾਡੇ ਦੇਸ਼ ਨੂੰ ਥੋੜ੍ਹਾ ਟਾਈਮ ਲੱਗ ਜਾਣਾ ਬਾਕੀਆਂ ਦੀ ਤੁਲਨਾ ਨਾਲੋਂ ਪਰ ਹੁਣ ਉਹ ਸਮਾਂ ਦੂਰ ਨਹੀਂ ਜਦ ਸਾਡੇ ਦੇਸ਼ ਵਿੱਚ ਵੀ ਬਾਹਰਲੇ ਦੇਸ਼ ਦੇ ਬੱਚੇ ਪੜ੍ਹਨ ਆਉਣਗੇ ਧੰਨਵਾਦ ਜੀ